ਮੈਂ ਕਾਫੀ ਦਿਨ ਤੋਂ ਹੈੱਡਫ਼ੋਨ ਟਰਾਈ ਕਰ ਰਿਹਾ ਸੀ ਰੋਪੜ ਟਰਾਈ ਕੀਤੇ ਨੇ ਇੱਕ ਦੋ ਜਗ੍ਹਾ ਹੋਰ ਟਰਾਈ ਕੀਤੇ ਨੇ ਤਾਂ ਉਸ ਤੋਂ ਬਾਅਦ ਮੈਂ ਔਨਲਾਈਨ ਆਰਡਰ ਕੀਤੇ ਤਾਂ ਜਦੋਂ ਡਿਲੀਵਰ ਹੋਏ ਮੇਰੇ ਕੋਲ ਤਾਂ ਉਸਦੀ ਪੈਕਿੰਗ ਬਹੁਤ ਵਧੀਆ ਸੀ ਤਾਂ ਜਦੋਂ ਯੂਜ਼ ਕੀਤੇ ਤਾਂ ਉਹਦੀ ਆਵਾਜ਼ ਦੀ ਬਿਲਕੁਲ ਹੀ ਕਲੈਰਟੀ ਨਹੀਂ ਸੀ ਬਹੁਤ ਬੇਕਾਰ ਜਿਹੀ ਆਵਾਜ਼ ਸੀ ਤਾਂ ਇੱਕ ਤਾਂ ਹੈ ਮਹਿੰਗੇ ਸੀ ਅਤੇ ਬਜਟ ਤੋਂ ਬਾਹਰ ਸੀ ਫਿਰ ਵੀ ਮੈਂ ਆਰਡਰ ਕੀਤੇ ਬਾਈ ਸੌ ਦੇ ਮੈਂ ਆਰਡਰ ਕੀਤੇ ਸੀ ਤਾਂ ਜੋ ਉਹਦੀ ਆਵਾਜ਼ ਸੀ ਬੇਸ ਸੀ ਤਾਂ ਬਿਲਕੁਲ ਹੀ ਬੇਕਾਰ ਸੀ ਜਦੋਂ ਦੇ ਮੈਂ ਯੂਜ਼ ਕਰ ਰਿਹਾ ਤਾਂ ਉਦੋਂ ਦਾ ਕਾਫੀ ਜ਼ਿਆਦਾ ਸਿਰ ਦਰਦ ਔਰ ਕੰਨਾਂ ਦੇ ਵਿੱਚ ਪੇਨ ਹੁੰਦੀ ਹੈ ਤਾਂ ਉਸ ਤੋਂ ਬਾਅਦ ਮੈਂ ਆਪਣੇ ਫਰੈਂਡਸ ਨਾਲ ਗੱਲ ਸ਼ੇਅਰ ਕੀਤੀ ਤਾਂ ਮੈਂ ਉਹਨੂੰ ਦਿਖਾਏ ਤਾਂ ਉਸਨੂੰ ਬੋਲਿਆ ਮੈਂ ਕਿ ਤੂੰ ਯੂਜ਼ ਕਰ ਇਹਨੂੰ ਤਾਂ ਉਹ ਯੂਜ਼ ਕਰ ਰਿਹਾ ਦੋ ਤਿੰਨ ਦਿਨ ਤੋਂ ਤਾਂ ਉਸਨੂੰ ਵੀ ਇਹ ਸੇਮ ਦਿੱਕਤ ਇਹ ਆ ਰਹੀ ਹੈ ਤਾਂ ਜੋ ਵੀ ਮੇਰਾ ਐਕਸਪੀਰੀਐਂਸ ਰਿਹਾ ਇਸ ਵਾਸਤੇ ਤਾਂ ਉਹ ਬਹੁਤ ਬੇਕਾਰ ਸੀ ਜਿੰਨੀ ਉਸਦੀ ਪੈਕਿੰਗ ਵੱਧੀਆ ਸੀ ਤਾਂ ਕੁਆਲਿਟੀ ਨਹੀਂ ਸੀ ਬਿਲਕੁਲ ਵੀ